ਪੰਜ ਜਨਵਰੀ ਉੱਨੀ ਸੌ ਉਣਹੱਤਰ ਉਨੱਤੀ ਮਈ ਦੋ ਹਜ਼ਾਰ ਤਿੰਨ ਛੱਬੀ ਜਨਵਰੀ ਉੱਨੀ ਸੌ ਪੰਜਾਹ ਇੱਕ ਦਸੰਬਰ ਦੋ ਹਜ਼ਾਰ ਅੱਠ ਛੇ ਮਈ ਦੋ ਹਜ਼ਾਰ ਚਾਰ